ਸਤਿ ਸ਼੍ਰੀ ਅਕਾਲ ਜੀ ਮੈਂ ਦੋ ਘੰਟੇ ਪਹਿਲਾਂ ਤੁਹਾਡੇ ਤੋਂ ਖਾਣਾ ਔਡਰ ਕਰਵਾਇਆ ਸੀਗਾ ਅਤੇ ਉਸ ਖਾਣੇ ਦਾ ਮੈਂ ਰਿਵਿਊ ਤੁਹਾਨੂੰ ਦੇਣਾ ਚਾਹੁੰਦੀ ਹਾਂ ਖਾਣੇ ਦੇ ਵਿੱਚ ਮੈਂ ਦਾਲ਼ ਮੱਖਣੀ ਕੜਾਹੀ ਪਨੀਰ ਪਨੀਰ ਦੀ ਭੁਰ ਭੁਰਜੀ ਨਾਨ ਅਤੇ ਲੱਛੇ ਪਰਾਂਠੇ ਮੰਗਵਾਏ ਸੀਗੇ ਜੋ ਕਿ ਖਾਣ ਦੇ ਵਿੱਚ ਬਹੁਤ ਹੀ ਜਿਆਦਾ ਸਵਾਦ ਸੀਗੇ ਅਤੇ ਲੱਛਾ ਪਰੌਂਠਾ ਵੀ ਇੰਨਾ ਜਿਆਦਾ ਨਰਮ ਸੀਗਾ ਕਿ ਅੱਜ ਤੱਕ ਮੈਂ ਕਿਤੋਂ ਹੋਰ ਪਹਿਲਾਂ ਵੀ ਮੰਗਵਾਏ ਨਾ ਕਾਫੀ ਜਗ੍ਹਾ ਤੋਂ ਅੱਜ ਤੱਕ ਇੱਦਾਂ ਦੇ ਇੱਦਾਂ ਦਾ ਖਾਣਾ ਮੈਨੂੰ ਨਹੀਂ ਮਿਲਿਆ ਮੇਰੇ ਪਰਿਵਾਰ ਨੂੰ ਅਤੇ ਬਾਕੀ ਮੇਰੇ ਫਰੈਂਡਸ ਆਏ ਹੋਏ ਸੀਗੇ ਉਹਨਾਂ ਨੂੰ ਵੀ ਤੁਹਾਡਾ ਖਾਣਾ ਬਹੁਤ ਜਿਆਦਾ ਪਸੰਦ ਆਇਆ ਅਤੇ ਜਿਹੜਾ ਡਿਲੀਵਰੀ ਬੋਆਏ ਸੀਗਾ ਉਹਨੇ ਨਿਰਧਾਰਤ ਕੀਤੇ ਸਮੇਂ 'ਤੇ ਹੀ ਆਇਆ ਬਿਲਕੁਲ ਵੀ ਲੇਟ ਨਹੀਂ ਸੀਗੀ ਅਤੇ ਖਾਣ ਦਾ ਜਿਹੜੇ ਕੁਆਲਿਟੀ ਅਤੇ ਕੁਆਂਟਿਟੀ ਬਹੁਤ ਜਿਆਦਾ ਵਧੀਆ ਸੀ ਅਸੀਂ ਤਿੰਨ ਬੰਦਿਆਂ ਦਾ ਖਾਣਾ ਮੰਗਵਾਇਆ ਸੀ ਪਰ ਫਿਰ ਵੀ ਸਾਡੇ ਕੋਲ ਖਾਣਾ ਬਹੁਤ ਜਿਆਦਾ ਬਚ ਗਿਆ ਅਤੇ ਅਸੀਂ ਨਾਲ਼ ਦੇ ਜਿਹੜੇ ਹੋਰ ਬਾਅਦ ਚੋਂ ਬੰਦੇ ਆਏ ਸੀਗੇ ਉਹਨਾਂ ਨੂੰ ਵੀ ਉਹ ਖਾਣਾ ਦੇ ਦਿੱਤਾ ਅਤੇ ਸਾਰਿਆਂ ਨੂੰ ਖਾਣਾ ਬਹੁਤ ਜਿਆਦਾ ਪਸੰਦ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਐਨਾਂ ਵਧੀਆ ਖਾਣਾ ਭਿਜਵਾਉਣ ਵਾਸਤੇ ਅਤੇ ਅੱਗੇ ਨੂੰ ਵੀ ਅਸੀਂ ਇਹ ਖਾਣਾ ਮੰਗਵਾਉਂਦੇ ਰਹਾਂਗੇ